ਪੇਂਡੂ ਖੇਤਰ ਵਿੱਚ ਨੌਜਵਾਨ ਪੀੜ੍ਹੀ ਨੂੰ ਜੀਵਨ ਸਾਥੀ ਪ੍ਰਾਪਤ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਇਸ ਕਰਕੇ ਕਰਨਾ ਪੈਂਦਾ ਹੈ ਕਿਉਂਕਿ ਅੱਜ ਕੱਲ੍ਹ ਲੋਕ ਪਿੰਡਾਂ ਵਿੱਚੋਂ ਨਿਕਲ ਕੇ ਸ਼ਹਿਰ ਵਿੱਚ ਵਸਣਾ ਚਾਹੁੰਦੇ ਹਨ ਅਤੇ ਜਿਹੜੇ ਵੀ ਧੀ ਵਾਲੇ ਹੁੰਦੇ ਹਨ ਧੀ ਦੇ ਮਾਂ ਪਿਓ ਚਾਹੁੰਦੇ ਹਨ ਕਿ ਸਾਡੀ ਧੀ ਹਰ ਸੁੱਖ ਸੁਵਿਧਾ ਦੇ ਨਾਲ ਆਪਣਾ ਜੀਵਨ ਦਾ ਆਨੰਦ ਮਾਣੇ ਅਤੇ ਸੁੱਖ ਸੁਵਿਧਾਵਾਂ ਸ਼ਹਿਰ ਵਿੱਚ ਜ਼ਿਆਦਾ ਨੇ ਹਾਲਾਂਕਿ ਪਿੰਡ ਦੀ ਆਬੋ ਹਵਾ ਬਹੁਤ ਵਧੀਆ ਹੁੰਦੀ ਹੈ ਪਿੰਡ ਦੇ ਲੋਕ ਜ਼ਮੀਨ ਨਾਲ ਜੁੜੇ ਹੁੰਦੇ ਹਨ ਮਗਰ ਸ਼ਹਿਰ ਦੇ ਵਿੱਚ ਸਾਨੂੰ ਜ਼ਿਆਦਾ ਸੁਵਿਧਾਵਾਂ ਮਿਲਦੀਆਂ ਹਨ ਜਿਵੇਂ ਕਿ ਗੱਡੀਆਂ ਸਾਫ਼ ਘਰ ਨੌਕਰੀਆਂ ਫਿਰ ਬਹਿਣਾ ਖਲ੍ਹੋਣਾ ਇਲੈਕਟ੍ਰੋਨਿਕਸ ਦੇ ਹੋਰ ਵੀ ਸਮਾਨ ਪਿੰਡਾਂ ਵਿੱਚ ਸਾਰਾ ਕੰਮ ਹੱਥਾਂ ਨਾਲ ਹੀ ਹੁੰਦਾ ਹੈ ਤਾਂ ਜੋ ਅੱਜ ਕੱਲ੍ਹ ਐਡਵਾਂਸ ਮਾਡਰਨ ਕੁੜੀਆਂ ਅਤੇ ਉਹਨਾਂ ਦੇ ਮਾਂ ਪਿਓ ਪਿੰਡਾਂ ਵਿੱਚ ਆਪਣੀ ਧੀ ਵਿਹਾਉਣਾ ਨਹੀਂ ਚਾਹੁੰਦੇ ਅਤੇ ਉਹ ਸ਼ਹਿਰ ਦੇ ਵਿੱਚ ਰਹਿ ਕੇ ਹੀ ਸ਼ਹਿਰ ਦੇ ਸੁੱਖ ਮਾਨਣਾ ਚਾਹੁੰਦੇ ਹਨ ਇਸ ਕਰਕੇ ਪੇਂਡੂ ਖੇਤਰ ਵਿੱਚ ਨੌਜਵਾਨ ਪੀੜ੍ਹੀ ਨੂੰ ਜੀਵਨ ਸਾਥੀ ਪ੍ਰਾਪਤ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ